ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਤੁਹਾਡੇ ਐਪ ਤੋਂ ਹਾਂਜੀ ਜੀ ਜੀ ਮੈਂ ਤੁਹਾਡੇ ਐਪ ਤੋਂ ਨਾ ਇੱਕ ਜੈਕਟ ਔਡਰ ਕੀ ਕੀਤੀ ਸੀ ਜੀ ਮੇਰੇ ਕੋਲ ਪਹੁੰਚ ਗਈ ਹੈ ਹਾਂਜੀ ਬਹੁਤ ਹੀ ਵਧੀਆ ਹਾਂਜੀ ਬਹੁਤ ਵਧੀਆ ਲੱਗੀ ਮੈਨੂੰ ਜੈਕਟ ਅਤੇ ਉਹਦਾ ਬਰਾਊਨ ਕਲਰ ਜਿਸ ਤਰ੍ਹਾਂ ਦਾ ਮੈਂ ਮੰਗਵਾਇਆ ਸੀਗਾ ਉਹੀ ਸ਼ੇਡ ਮੈਨੂੰ ਮਿਲੀ ਹੈ ਹਾਂਜੀ ਲੈਦਰ ਦੇ ਵਿਚ ਕਹੀ ਸੀਗੀ ਮੈਂ ਅਤੇ ਲੈਦਰ ਦੇ ਵਿੱਚ ਹੀ ਆਈ ਹੈਗੀ ਐ ਜੀ ਕਿੰਨੀ ਵਾਰੀ ਇਸ ਤਰ੍ਹਾਂ ਹੁੰਦਾ ਹੈ ਨਾ ਕਿ ਆਪਾਂ ਕੋਈ ਚੀਜ਼ ਕੁਛ ਔਡਰ ਕਰਦੇ ਹਾਂ ਅਤੇ ਸਾਡੇ ਤੀਕਰ ਪਹੁੰਚਦੀ ਕੁਛ ਹੋਰ ਹੁੰਦੀ ਹੈਗੀ ਐ ਅਤੇ ਡਿਫੈਕਟਿਡ ਕਦੀ ਕਦੀ ਪੀਸ ਆ ਜਾਂਦੇ ਹੈਗੇ ਐ ਹਾਂਜੀ ਚੀਜ਼ ਵੀ ਬਿਲਕੁਲ ਵਧੀਆ ਨਹੀਂ ਆਉਂਦੀ ਹੈਗੀ ਹੈ ਆ ਹਾਂਜੀ ਅਤੇ ਜੇ ਅਸੀਂ ਉਸ ਪ੍ਰੋਡਕ ਅਪ ਨੂੰ ਆਪਣਾ ਚੇਂਜ ਕਰਨਾ ਹੋਵੇ ਤਾਂ ਚੇਂਜ ਵੀ ਨਹੀਂ ਹੁੰਦੀ ਹਾਂਜੀ ਨਹੀਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੈਂ ਆਪਣੀ ਅਫ਼ ਹਾਂਜੀ ਮੈਂ ਆਪਣੀ ਸਹੇਲੀ ਦੇ ਕਹਿਣ 'ਤੇ ਤੁਹਾਡੇ ਇਸ ਐਪ ਤੋਂ ਡਾਊਨਲੋਨ ਕਰ ਕਰਵਾਈ ਸੀ ਹਾਂਜੀ ਜੀ ਜੀ ਮੈਂ ਬਰਾਊਨ ਕਲਰ ਹੀ ਲਿਖਿਆ ਸੀਗਾ ਅਤੇ ਬਰਾਊਨ ਕਲਰ ਹੀ ਆਇਆ ਹੈਗਾ ਹਾਂਜੀ ਜੀ ਮੈਂ ਪਾ ਕੇ ਚੈੱਕ ਕੀਤੀ ਹੈ ਅਤੇ ਬਹੁਤ ਹੀ ਵਧੀਆ ਲੱਗੀ ਮੈਨੂੰ ਫਿਟਿੰਗ ਵੀ ਬਹੁਤ ਸੋਹਣੀ ਸੀਗੀ ਹਾਂਜੀ ਮੈਂ ਕਾਫੀ ਮਾਰਕੀਟ ਵਗੈਰਾ ਸ਼ੌਪਿੰਗ ਕਰਨ ਗਈ ਅਤੇ ਮੈਂ ਜੈਕਟ ਮੈਨੂੰ ਨਾ ਕੋਈ ਪਸੰਦ ਹੀ ਨਹੀਂ ਆ ਰਹੀ ਸੀਗੀ ਅਤੇ ਫਿਰ ਮੇਰੀ ਫਰੈਂਡ ਨੇ ਦੱਸਿਆ ਕਿ ਉਹਨੇ ਵੀ ਨਾ ਤੁਹਾਡੇ ਐਪ ਤੋਂ ਇਸ ਤਰ੍ਹਾਂ ਡਾਊਨਲੋਡ ਕਰਵਾਈ ਹੈ ਆਪਣੀ ਅਤੇ ਐਪ ਤੋਂ ਹਾਂਜੀ ਹਾਂਜੀ ਹਾਂਜੀ ਨਹੀਂ ਜੀ ਬਿਲਕੁਲ ਜੇ ਵਧੀਆ ਚੀਜ਼ ਆਈ ਹੈ ਅਤੇ ਅਸੀਂ ਹੋਰ ਵੀ ਆਪਣੇ ਫਰੈਂਡ ਸਰਕਲ 'ਚ ਦੱਸਾਂਗੇ ਹਾਂਜੀ ਜੀ ਤੁਹਾਡਾ ਬਹੁਤ ਵਧੀਆ ਮਤਲਬ ਕਿ ਅਪ ਜੋ ਵੀ ਤੁਸੀਂ ਪ੍ਰੋਡਕ ਭੇਜਦੇ ਹੋ ਹਾਂਜੀ ਨਹੀਂ ਥੈਂਕਸ ਟੂ ਯੂ ਮੈਮ ਹਾਂਜੀ ਜੀ ਬਿਲਕੁਲ ਹਾਂਜੀ ਨਹੀਂ ਮੈਂ ਆਪਣੇ ਰਿਲੇਟਿਵ ਦੇ ਵਿੱਚ ਵੀ ਸਾਰਿਆਂ ਨੂੰ ਦੱਸਾਂਗੀ ਕਿ ਬਹੁਤ ਵਧੀਆ ਤੁਹਾਡੇ ਐਪ ਤੋਂ ਮੈਂ ਇੱਕ ਜੈਕਟ ਮੰਗਵਾਈ ਹੈ ਬਹੁਤ ਹੀ ਸੋਹਣੀ ਲੱਗੀ ਮੈਨੂੰ ਅਤੇ ਮੈਂ ਅੱਗੇ ਤੋਂ ਵੀ ਟਰਾਈ ਕਰਾਂਗੀ ਕਿ ਮੈਂ ਕੁਛ ਹੋਰ ਵੀ ਜੇ ਮੰਗਵਾਉਣਾ ਹੋਇਆ ਤਾਂ ਹਾਂਜੀ ਉਮੀਦ ਕਰਦੀ ਹਾਂ ਕਿ ਅੱਗੇ ਤੋਂ ਵੀ ਜੋ ਵੀ ਮੈਂ ਚੀਜ਼ ਹਾਂਜੀ ਮੰਗਵਾਵਾਂਗੀ ਔਡਰ ਕਰਾਂਗੀ ਅਤੇ ਤੁਸੀਂ ਉਹੀ ਚੀਜ਼ ਭੇਜੋਗੇ ਜੀ ਕਿੰਨੀ ਵਾਰੀ ਹੁੰਦਾ ਹੈ ਨਾ ਕਿ ਅਸੀਂ ਕੁਛ ਮੰਗਵਾਉਂਦੇ ਹਾਂ ਅਤੇ ਸਾਡੇ ਤੱਕ ਪਹੁੰਚਦਾ ਕੁਛ ਹੋਰ ਹੀ ਹੁੰਦਾ ਹੈ ਡਿਫੈਕਟਿਡ ਪੀਸ ਹੀ ਆ ਜਾਂਦੇ ਨੇ ਹਾਂਜੀ ਜਿਹਦੇ ਕਰਕੇ ਕਸਟਮਰ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਫਿਰ ਉਹ ਚੀਜ਼ ਵਾਪਸ ਵੀ ਨਹੀਂ ਹੁੰਦੀ ਹੈਗੀ ਐ ਫਿਰ ਸਾਡੇ ਪੈਸੇ ਵੀ ਵੇਸਟ ਹੋ ਹੋ ਜਾਂਦੇ ਨੇ ਨਹੀਂ ਜੀ ਤੁਹਾਡਾ ਤਾਂ ਰੀਨੇਜਬਲ ਸੀਗਾ ਹਾਂਜੀ ਬਿਲਕੁਲ ਨਹੀਂ ਮਾਰਕੀਟ ਪ੍ਰਾਈਜ਼ ਨਾਲੋਂ ਤਾਂ ਸਹੀ ਲੱਗੀ ਮੈਨੂੰ ਬਸ ਹੁਣ ਚੀਜ਼ ਵਧੀਆ ਨਿਕਲੇ ਠੀਕ ਹੈ ਜੀ ਹਾਂਜੀ ਜੀ ਥੈਂਕ ਯੂ ਹਾਂਜੀ ਜੀ ਨਹੀਂ ਜੀ ਜ਼ਰੂਰ ਅਸੀਂ ਫਿਰ ਵੀ ਕੋਈ ਚੀਜ਼ ਮੰਗਵਾਉਣੀ ਹੋਈ ਤਾਂ ਅਸੀਂ ਦੁਬਾਰਾ ਫਿਰ ਔਡਰ ਕਰਾਂਗੇ ਹਾਂਜੀ ਮੈਂ ਨਾ ਪੁੱਛਣਾ ਚਾਹੁੰਦੀ ਸੀਗੀ ਕਿ ਇਹਦੇ ਵਿੱਚ ਅਗਰ ਜੇ ਸਮੋਲ ਸਾਈਜ਼ ਵੀ ਲੈਣਾ ਹੋਵੇ ਤਾਂ ਹਾਂਜੀ ਮੈਂ ਡਬਲ ਐਕਸ ਲ ਮੰਗਵਾਇਆ ਸੀਗਾ ਨਾ ਅਤੇ ਡਬਲ ਐਕਸ ਲ ਆਇਆ ਹੈਗਾ ਅਤੇ ਮੈਂ ਕਿਹਾ ਜੇ ਐੱਲ ਸਾਈਜ ਵਿੱਚ ਹੀ ਲੈਣੀ ਹੋਵੇ ਸੇਮ ਲੈਦਰ ਸਟੱਫ਼ ਵਿੱਚ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਤਾਂ ਫਿਰ ਮੈਂ ਇੱਕ ਸਮੋਲ ਸਾਈਜ਼ ਦੇ ਵਿੱਚ ਵੀ ਨਾ ਇੱਕ ਔਡਰ ਅ ਹੋਰ ਕਰ ਦਿੰਦੀ ਹਾਂ ਅਤੇ ਤੁਸੀਂ ਮੈਨੂੰ ਇਹ ਕੋਸ਼ਿਸ਼ ਕਰਿਓ ਕਿ ਇਹੀ ਪ੍ਰੋਡਕ ਮੇਰੇ ਕੋਲ ਆਵੇ ਹਾਂਜੀ ਜੀ ਜੀ ਧੰਨਵਾਦ

ਜੀ ਸ਼ੁਕਰੀਆ